ਜੇਕਰ ਅਸੀਂ ਪੰਜਾਬ ਦੇ ਜਿਲ੍ਹਿਆਂ ਦੀ ਗੱਲ ਕਰੀਏ ਤਾਂ ਹਰੇਕ ਜਿਲ੍ਹੇ ਦੀ ਅਲੱਗ ਹੀ ਭਾਸ਼ਾ ਅਲੱਗ ਹੀ ਰੀਤੀ ਰਿਵਾਜ ਅਤੇ ਅਲੱਗ ਹੀ ਧਰਮ ਹੁੰਦੇ ਹਨ ਜੇਕਰ ਅਸੀਂ ਫਤਿਹਗੜ੍ਹ ਸਾਹਿਬ ਜਿਲ੍ਹੇ ਦੀ ਗੱਲ ਕਰਦੇ ਹਾਂ ਤਾਂ ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਅਲੱਗ ਭਾਸ਼ਾ ਧਰਮ ਅਤੇ ਰੀਤੀ ਰਿਵਾਜ਼ ਵਾਲੇ ਲੋਕ ਮਿਲਣਗੇ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਜੇਕਰ ਆਪਾਂ ਕਿਸੀ ਇਹ ਲੜਕਾ ਲੜਕੀ ਦਾ ਵਿਆਹ ਕਰਾਉਂਦੇ ਹਾਂ ਤਾਂ ਇਹ ਵਿਆਹ ਗੁਰਦੁਆਰਾ ਸਾਹਿਬ ਵਿੱਚ ਲਾਵਾਂ 'ਤੇ ਨਾਲ ਕਰਵਾਉਂਦੇ ਜਾਂਦਾ ਹੈ ਇਹ ਸਿੱਖ ਧਰਮ ਦੀ ਪ੍ਰਪਰਾ ਹੈ ਜੇਕਰ ਇਹ ਇਹ ਆਪਾਂ ਵਿਆਹ ਹਿੰਦੂ ਧਰਮ ਵਿੱਚ ਕਰਾਉਂਦੇ ਹਾਂ ਤਾਂ ਇਹ ਹਿੰਦੂ ਧਰਮ ਦੀ ਪ੍ਰਪਰਾ ਅਨੁਸਾਰ ਵਿਆਹ ਮੰਦਰਾਂ ਵਿੱਚ ਕਰਾਇਆ ਜਾਂਦਾ ਹੈ ਅਤੇ ਫੇਰੇ ਲਿੱਤੇ ਜਾਂਦੇ ਹਨ ਜੇ ਇਸੇ ਤਰ੍ਹਾਂ ਆਪਾਂ ਮੁਸਲਿਮ ਧਰਮ ਧਰਮ ਦੀ ਗੱਲ ਕਰੀਏ ਤਾਂ ਇਹ ਸੁਣਨ ਨੂੰ ਮਿਲਦਾ ਹੈ ਕਿ ਮੁਸਲਿਮ ਲੋਕ ਮਸੀਦ ਵਿੱਚ ਨਿਕਾਹ ਅਤੇ ਪੜਾਣ ਦੇ ਤੌਰ 'ਤੇ ਵਿਆਹ ਕਰਦੇ ਹਨ ਇਸੇ ਤਰ੍ਹਾਂ ਹਰੇਕ ਧਰਮ ਦੀ ਆਪਣੀ ਆਪਣੀ ਰੀਤੀ ਰਿਵਾਜ ਹੁੰਦੇ ਹਨ ਜੋ ਕਿ ਪੀੜੀ ਦਰ ਪੀੜੀ ਚੱਲਦੇ ਰਹਿੰਦੇ ਹਨ ਜਿਹੜੇ ਕਿ ਰੀਤੀ ਰਿਵਾਜ ਕਦੇ ਵੀ ਬਦਲੇ ਨਹੀਂ ਜਾ ਸਕਦੇ ਹਰੇਕ ਧਰਮ ਦਾ ਆਪਣਾ ਹੀ ਪ੍ਰੰਪਰਾਵਾਂ ਹੁੰਦੀਆਂ ਹਨ ਜੋ ਕਿ ਪੀੜੀ ਦਰ ਪੀੜੀ ਚੱਲ ਚੱਲਦੀਆਂ ਰਹਿੰਦੀਆਂ ਹਨ